ਹਾਂ ਅਸੀਂ ਧਾਰਮਿਕ ਮੌਕਿਆਂ ਉੱਤੇ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦੇ ਹਾਂ ਅਸੀਂ ਮੂਰਤੀਆਂ ਮਿੱਟੀ ਦੀ ਮੂਰਤੀਆਂ ਬਣਾਉਂਦੇ ਹਾਂ ਮਿੱਟੀ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਨੂੰ ਕਈ ਰੰਗਾਂ ਦੇ ਨਾਲ ਰੰਗਾਂ ਦੇ ਨਾਲ ਸਜਾਇਆ ਜਾਂਦਾ ਹੈ ਰੰਗਾਂ ਨਾਲ ਸਜਾ ਕੇ ਉਹਨਾਂ ਨੂੰ ਦੀਵਾਰ 'ਤੇ ਚਿਪਕਾਇਆ ਜਾਂਦਾ ਹੈ ਇਹ ਅੱਸੂ ਦੇ ਨਰਾਤਿਆਂ 'ਚ ਬਣਾਈਆਂ ਜਾਂਦੀਆਂ ਹਨ ਅੱਸੂ ਦਿਨ ਜਿਸ ਦਿਨ ਦੁਸਹਿਰਾ ਹੁੰਦਾ ਹੈ ਉਸ ਦਿਨ ਇਹ ਆਪਣੇ ਨੇੜੇ ਦੇ ਉਤਾਰ ਕੇ ਨੇੜੇ ਦੇ ਕਿਤੇ ਵੀ ਨਦੀ ਵਿੱਚ ਜਾ ਕੇ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਹਨ ਅਤੇ ਬਹੁਤ ਵਧੀਆ ਅਨੁਭਵ ਹੁੰਦਾ ਹੈ